ਭਾਰਤ ਵਿੱਚ ਪ੍ਰਾਚੀਨ ਅਤੇ ਮੱਧਕਾਲੀਨ ਦੌਰ ਵਿੱਚ ਸਾਡੇ ਕੁਝ ਮਸ਼ਹੂਰ ਰਾਜੇ ਰਹਿ ਚੁੱਕੇ ਹਨ ਜਿਨ੍ਹਾਂ ਨੇ ਪ੍ਰਾਚੀਨ ਅਤੇ ਮੱਧਕਾਲੀਨ ਦੌਰਾਨ ਰਾਜ ਕੀਤਾ ਜਿਨ੍ਹਾਂ ਵਿੱਚ ਕਿ ਅਕਬਰ ਸ਼ਿਵਾਜੀ ਸ਼ਾਹ ਜਹਾਂ ਮਹਾਰਾਜਾ ਰਣਜੀਤ ਸਿੰਘ ਅਤੇ ਜਹਾਂਗੀਰ ਵਰਗੇ ਰਾਜਿਆਂ ਨੇ ਰਾਜ ਕੀਤਾ ਇਹਨਾਂ ਵਿੱਚੋਂ ਅਕਬਰ ਜੋ ਕਿ ਭਾਰਤ ਦੇ ਮੁਗਲ ਸਮਰਾਟਾਂ ਵਿੱਚੋਂ ਸਭ ਤੋਂ ਮਹਾਨ ਰਾਜੇ ਰਹਿ ਚੁੱਕੇ ਹਨ ਉਹਨਾਂ ਨੇ ਪੰਦਰਾਂ ਸੌ ਛਪੰਜਾ ਤੋਂ ਸੋਲਾਂ ਸੌ ਪੰਜ ਤੱਕ ਰਾਜ ਕੀਤਾ ਅਤੇ ਭਾਰਤੀ ਉਪ ਮਹਾਂਦੀਪ ਦੇ ਜ਼ਿਆਦਾਤਰ ਹਿੱਸੇ ਉੱਤੇ ਮੁਗ਼ਲ ਸੱਤਾ ਦਾ ਵਿਸਥਾਰ ਕੀਤਾ ਆਪਣੇ ਸਾਮਰਾਜ ਦੀ ਏਕਤਾ ਨੂੰ ਬਰਕਰਾਰ ਰੱਖਣ ਲਈ ਅਕਬਰ ਨੇ ਅਜਿਹੇ ਪ੍ਰੋਗਰਾਮ ਅਪਣਾਏ ਜਿਨ੍ਹਾਂ ਨੇ ਉਸਦੇ ਖੇਤਰ ਦੀ ਗੈਰ ਮੁਸਲਿਮ ਆਬਾਦੀ ਦੀ ਵਫ਼ਾਦਾਰੀ ਜਿੱਤੀ ਇਸ ਤੋਂ ਇਲਾਵਾ ਸ਼ਿਵਾਜੀ ਮਰਾਠਾ ਜਿਨ੍ਹਾਂ ਨੇ ਕਿ ਇਨ ਅਨਿਆਂਏ ਦੇ ਕੇ ਵਿਰੋ ਨਿਆਂਏ ਦੇ ਕ ਨਾਲ਼ ਰਹੇ ਅਤੇ ਅਤੇ ਬੁਰਾਈ ਦੇ ਖ਼ਿਲਾਫ਼ ਰਹਿ ਚੁੱਕੇ ਜਿਨ੍ਹਾਂ ਨੇ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਅਤੇ ਸਭ ਨੂੰ ਸਮਾਨਤਾ ਦੇਣ ਸਮਾਨਤਾ ਦਾ ਅਧਿਕਾਰ ਦਿੱਤਾ ਅਤੇ ਸਭ ਨੂੰ ਇੱਕ ਮਿਲਜੁਲ ਕੇ ਰਹਿਣ ਲਈ ਕਿਹਾ ਅਤੇ ਉਨ੍ਹਾਂ ਨੇ ਗਰੀਬ ਲੋਕਾਂ ਦਾ ਭਲਾ ਕੀਤਾ ਜਿਸ ਦੇ ਨਾਲ਼ ਕਿ ਉਹ ਉਸ ਸਮੇਂ ਦੇ ਮਹਾਨ ਸ਼ਿਵਾਜੀ ਮਹਾਨ ਰਾਜੇ ਰਹਿ ਚੁੱਕੇ ਅਤੇ ਉਹ ਇੱਕ ਬਹਾਦੁਰ ਵਿਅਕਤੀ ਵੀ ਰਹਿ ਚੁੱਕੇ ਹਨ ਜਿਨ੍ਹਾਂ ਨੇ ਕਈ ਲੋਕ ਗਰੀਬ ਲੋਕਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਦੀ ਜਾਨ ਬਚਾਈ